ਹਾਂ ਮੈਂ ਇੱਕ ਮੂਰਤੀ ਬਣਾਈ ਹੈ ਜਦੋਂ ਕਿ ਗਨੇਸ਼ ਚਤੁਰਥੀ ਹੁੰਦੀ ਹੈ ਤਾਂ ਮੇਰੀ ਟੀਮ ਮੂਰਤੀ ਬਣਾਉਣ ਵਿੱਚ ਹੈਲਪ ਕਰਦੀ ਹੈ ਇਸ ਵਾਰ ਸਾਨੂੰ ਬਹੁਤ ਵੱਡਾ ਔਡਰ ਮਿਲਿਆ ਸੀ ਅਤੇ ਮੈਂ ਗਣੇਸ਼ ਜੀ ਦੀ ਵੱਡੀ ਮੂਰਤੀ ਬਣਾਈ ਸੀ ਜੋ ਕਿ ਪੰਡਾਲ ਵਿੱਚ ਲੱਗਣੀ ਸੀ ਇਹ ਮੂਰਤੀ ਬਣਾ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਗਣੇਸ਼ ਜੀ ਮੇਰੀ ਬਹੁਤ ਜ਼ਿਆਦਾ ਮਦਦ ਕਰਦੇ ਨੇ ਹਰ ਇੱਕ ਕੰਮ 'ਚ ਅਤੇ ਇਹਦੀ ਪ੍ਰੇਰਨਾ ਇਹ ਸੀ ਕਿ ਜੋ ਮੇਰੇ ਟੀਚਰ ਸਨ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਕਿ ਮੈਂ ਵਧੀਆ ਮੂਰਤੀਆਂ ਬਣਾਉਂਦੀ ਹਾਂ ਅਤੇ ਮੈਨੂੰ ਮੂਰਤੀ ਬਣਾਉਣੀ ਚਾਹੀਦੀ ਹੈ ਇਹ ਅੋਫਰ ਅਸੈਪਟ ਕਰ ਲੈਣਾ ਚਾਹੀਦਾ ਹੈ ਮੈਂ ਉਸ ਅੋਫਰ ਨੂੰ ਅਸੈਪਟ ਕੀਤਾ ਉਹਨਾਂ ਦੇ ਕਹਿਣ 'ਤੇ ਅਤੇ ਮੈਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹ ਮੇਰਾ ਪਹਿਲੀ ਵਾਰ ਸੀ ਕੁਛ ਇੰਨਾ ਵੱਡਾ ਬਣਾਉਣ ਦਾ ਅਤੇ ਮੇਰੀ ਟੀਮ ਵੀ ਮੇਰਾ ਬਹੁਤ ਸਾਥ ਦਿੱਤਾ

ਅਤੇ ਕਈ ਹੋਰ ਜਿੱਦਾਂ ਕਿ ਕਲਰ ਵਗੈਰਾ 'ਚ ਵੀ ਮੈਨੂੰ ਦਿੱਕਤ ਆਈ ਕਿਉਂਕਿ ਅਸੀਂ ਪਹਿਲਾਂ ਛੋਟੇ ਔਡਰ 'ਤੇ ਸਭ ਕੁਛ ਕਰਦੇ ਹੁੰਦੇ ਹਾਂ ਅਤੇ ਇਹ ਵੱਡਾ ਔਡਰ ਸੀ ਅਤੇ ਸਾਡੇ ਕੋਲ ਥੋੜ੍ਹਾ ਹੈਂਡਲ ਹੋਣ 'ਚ ਪ੍ਰੋਬਲਮ ਆ ਰਹੀ ਸੀ ਪਰ ਜੋ ਵੀ ਸੀ ਅਸੀਂ ਗਨੇਸ਼ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਹੋਇਆ ਅਤੇ ਅਸੀਂ ਇਸ ਕੰਮ ਨੂੰ ਅੱਗੇ ਵੀ ਕਰਨਾ ਚਾਹਵਾਂਗੇ